ਗਾਉਣ ਦੇ ਵਿੱਚ ਸਾਹ ਨੂੰ ਨਿਰੰਤਰਨ ਰੱਖਣਾ ਇੱਕ ਬਹੁਤ ਹੀ ਔਖਾ ਕੰਮ ਹੈ ਇਸ ਨੂੰ ਕਰਨ ਦੇ ਲਈ ਬਹੁਤ ਸਾਰਾ ਅਭਿਆਸ ਹੋਣਾ ਚਾਹੀਦਾ ਹੈ ਅਤੇ ਇਸ ਅਤੇ ਸਾਹ ਨਿਰੰਤਰਨ ਦੀ ਸਿੰਗਿੰਗ ਦੇ ਵਿੱਚ ਬਹੁਤ ਹੀ ਅਹਿਮ ਭੂਮਿਕਾ ਹੈ ਜੇਕਰ ਅਸੀਂ ਸਾਹ ਨਿਰੰਤਰ ਕਰਨਾ ਨਹੀਂ ਸਿੱਖ ਪਾਏ ਤਾਂ ਸਾਨੂੰ ਸਿੰਗਿੰਗ ਕਰਨਾ ਨਹੀਂ ਆ ਸਕਦਾ ਕਿਉਂਕਿ ਜਦੋਂ ਵੀ ਕੋਈ ਸਿੰਗਰ ਗਾਣਾ ਗਾਉਂਦਾ ਹੈ ਤਾਂ ਉਸਦੀ ਹੇਕ ਬਹੁਤ ਲੰਬੀ ਹੋ ਜਾਂਦੀ ਹੈ ਅਗਰ ਅਗਰ ਉਹ ਆਪਣੇ ਸਾਹ ਨੂੰ ਨਿਰੰਤਰਨ ਰੱਖਣ ਰੱਖਣਾ ਆਉਂਦਾ ਹੋਵੇਗਾ ਅਗਰ ਉਸ ਸਿੰਗਰ ਨੂੰ ਤਾਂ ਹੀ ਉਹ ਹੇਕ ਲਗਾ ਸਕਦਾ ਹੈ ਨਹੀਂ ਤਾਂ ਉਹ ਉਸ ਨੂੰ ਗਾਣਾ ਅੱਧ ਵਿੱਚ ਹੀ ਛੱਡਣਾ ਪਵੇਗਾ ਕਿਉਂਕਿ ਹੇਕ ਲਾਉਂਦੇ ਸਮੇਂ ਕਾਫ਼ੀ ਜ਼ਿਆਦਾ ਸਾਹ ਚੜ ਜਾਂਦਾ ਹੈ ਅਤੇ ਜਦੋਂ ਹੇਕ ਨੂੰ ਛੱਡਣਾ ਹੋਏ ਤਦ ਵੀ ਬਹੁਤ ਬਹੁਤ ਜ਼ਿਆਦਾ ਸਾਹ ਆਉਂਦਾ ਹੈ ਤਾਂ ਇੱਕ ਸਿੰਗਰ ਨੂੰ ਬਹੁਤ ਜ਼ਿਆਦਾ ਅਭਿਆਸ ਦੀ ਲੋੜ ਹੁੰਦੀ ਹੈ ਸਾਹ ਨੂੰ ਨਿਰੰਤਰਨ ਕਰਨ ਦੇ ਲਈ ਮੈਂ ਤਾਂ ਇੱਕ ਪਰਫੈਕਟ ਸਿੰਗਰ ਨਹੀਂ ਹਾਂ ਪਰ ਅਗਰ ਮੈਨੂੰ ਦਿਨ ਦੇ ਵਿੱਚੋਂ ਟਾਈਮ ਮਿਲੇ ਤਾਂ ਮੈਂ ਇੱਕ ਦੋ ਘੰਟਾ ਰਿਆਜ਼ ਕਰ ਲੈਦੀ ਹਾਂ ਜਿਸ ਕਰਕੇ ਜਿਸ ਕਰਕੇ ਮੈਂ ਹੇਕ ਸਾਹ ਨੂੰ ਨਿਰੰਤਰਨ ਰੱਖਣ ਦੀ ਕੋਸ਼ਿਸ਼ ਕਰ ਸਕਾਂ ਪਰ ਅਗਰ ਜੇਕਰ ਇੱਕ ਪਰਫੈਕਟ ਸਿੰਗਰ ਹੈ ਤਾਂ ਉਸਨੂੰ ਘੱਟੋ ਘੱਟ ਇੱਕ ਦਿਨ ਦੇ ਵਿੱਚ ਤਿੰਨ ਤੋਂ ਚਾਰ ਘੰਟੇ ਸਾਹ ਨਿਰੰਤਰਨ ਰੱਖਣ ਦੀ ਪਰੈਕਟਿਸ ਕਰਨੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਸਿੰਗਿੰਗ ਸਕਿੱਲਸ ਜਿਹੜੇ ਨੇ ਉਹਨਾਂ ਨੂੰ ਵਧੀਆ ਬਣਾ ਸਕੇ ਆਪਣੇ ਸਿੰਗ ਸਿੰਗਿੰਗ ਸਕਿੱਲਸ ਨੂੰ ਹੋਰ ਵੀ ਜ਼ਿਆਦਾ ਉੱਚੀਆਂ ਮੰਜ਼ਿਲਾਂ 'ਤੇ ਪਹੁੰਚਾ ਸਕੇ ਮੇਰਾ ਬਸ ਇੰਨਾ ਹੀ ਕਹਿਣਾ ਹੈ ਕਿ ਅਗਰ ਤੁਸੀਂ ਇੱਕ ਪਰਫੈਕਟ ਸਿੰਗ ਸਿੰਗਰ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਅਭਿਆਸ ਕਰਨ ਦੀ ਲੋੜ ਹੈ ਸਪੈਸ਼ਲੀ ਤੌਰ 'ਤੇ ਤਾਂ ਸਾਹ ਨਿਰੰਤਰਨ ਰੱਖਣ ਦੀ ਬਹੁਤ ਲੋੜ ਹੈ